ਹੁਣ ਕੱਲ ਸਾਡੇ ਦੋ ਦੋਤੀ ਦਾ ਵਿਆਹ ਆ ਗਿਆ ਹੁਣ ਸਮਝ ਨਹੀਂ ਆਉਂਦੀ ਕੀ ਪਾਵਾਂ ਗਾਉਨ ਪਾਵਾਂ ਸਾੜੀ ਪਾਵਾਂ ਹੰਢਾਇਆਏ ਵਿਚ ਤਾਂ ਸਾਰੇ ਜਾ ਆਈ ਪਰ ਉਹ ਰੰਗ ਨਹੀਂ ਮਿਲਿਆ ਸੋਚਦੀ ਆ ਪਿੰਕ ਕਲਰ ਦਾ ਪਾਵਾਂ ਜਾਂ ਪੀਚ ਕਲਰ ਦਾ ਪਾਵਾਂ ਹੁਣ ਉੱਥੇ ਦਿੱਲੀ ਜਾਣਾ ਹਨਾ ਉੱਥੇ ਤਾਂ ਅਲੱਗ ਅਲੱਗ ਤਰ੍ਹਾਂ ਦੀ ਪਾਏ ਹੋਣਗੇ ਕਿਸੇ ਦੇ ਸਾੜੀ ਕਿਸੇ ਦੇ ਗਾਊਨ ਠੀਕ ਆ ਮੈਂ ਪੀਚ ਕਲਰ ਦਾ ਹੰਢਾਏ ਤਾਂ ਦੇਖ ਕੇ ਆਈ ਸੀ ਪਰ ਉਹਦਾ ਕੱਪੜਾ ਨਹੀਂ ਵਧੀਆ ਸੀਗਾ ਤੇ ਬਰਨਾਲੇ ਵੀ ਗਈ ਸੀ ਕੱਲ ਉਥੇ ਲਿਬਾਸ ਵਾਲਿਆਂ ਦੇ ਦੇਖਿਆ ਨਾ ਤਾਂ ਉਹਨਾਂ ਦੇ ਵਧੀਆ ਮਿਲਿਆ ਸੰਸਾਰੀ ਲਾਲ ਦੇ ਦੇਖਿਆ ਉਹਨਾਂ ਦੇ ਵੀ ਨੀ ਵਧੀਆ ਮਿਲਿਆ ਠੀਕ ਹੈ ਪਟਿਆਲੇ ਗਈ ਪਟਿਆਲੇ ਉਹਨਾਂ ਦਾ ਰੇਟ ਬਹੁਤ ਸੀਗਾ ਤੇ ਹੋਰ ਚੰਡੀਗੜ੍ਹ ਗਈ ਫਿਰ ਚੰਡੀਗੜ੍ਹ ਵੀ ਉਥੇ ਵੀ ਕਈ ਦੁਕਾਨਾਂ ਤੇ ਦੇਖਿਆ ਪੀਚ ਕਲਰ ਦਾ ਗਾਊਨ ਸਾੜ ਇੱਕ ਸਾੜੀ ਵੀ ਮੈਨੂੰ ਵਧੀਆ ਲੱਗੀ ਸੀ ਪਰ ਉਹਦੀ ਉਹ ਜਿਆਦਾ ਕੱਪੜਾ ਬਹੁਤ ਜਿਆਦਾ ਪਤਲਾ ਸੀਗਾ ਤੇ ਹੁਣ ਦੇਖਦੇ ਆਂ ਲੁਧਿਆਣੇ ਜਾਊਗੀ ਲੁਧਿਆਣੇ ਜਾ ਕੇ ਉਥੇ ਦੇਖੋ ਜੇ ਕੋਈ ਪਸੰਦ ਆ ਗਿਆ ਚਲ ਜੇ ਨਾ ਫਿਰ ਲੁਧਿਆਣੇ ਪਸੰਦ ਆ ਗਿਆ ਫਿਰ ਚੰਡੀਗੜ੍ਹ ਜਾਣਾ ਚੰਡੀਗੜ੍ਹ ਜਾ ਕੇ ਉੱਥੇ ਵੀ ਅਲੱਗ ਅਲੱਗ ਤਰ੍ਹਾਂ ਦੀਆਂ ਵਰਾਈਟੀਆਂ ਹੁੰਦੀਆਂ ਗਾਊਨ ਦੀਆਂ ਵੀ ਮਿਲ ਜਾਂਦੀਆਂ ਸਾੜੀ ਜਾਂ ਲਹਿੰਗਾ ਜੇ ਨਾ ਸਾੜੀ ਪਸੰਦ ਆਈ ਲਹਿੰਗਾ ਲੈ ਲਾਂਗੇ ਫਿਰ ਨੇ ਜੇ ਨਾ ਹੋਇਆ ਫਿਰ ਆਨਲਾਈਨ ਦੇਖ ਲਾਂਗੇ ਫਲਿੱਪਕਾਡ ਤੇ ਵੀ ਵਧੀਆ ਵਧੀਆ ਹੁੰਦੇ ਨੇ ਅਲੱਗ ਅਲੱਗ ਵਰਾਇਟੀ ਫਲਿੱਪਕਾਡ ਜਾਂ ਮਿਸ਼ੋ ਜਾਂ ਫਿਰ ਦੇਖ ਲਾਂਗੇ ਮਿਸ਼ੋ ਤੇ ਵੀ ਵਧੀਆ ਹੁੰਦੇ ਆ ਉਹਨਾਂ ਦੇ ਪ੍ਰਾਈਜ ਵੀ ਘੱਟ ਹੁੰਦੇ ਆ ਪੀਚ ਕਲਰ ਦਾ ਗਾਊਨ ਜੇ ਮਿਲ ਗਿਆ ਤਾਂ ਉਹਤੇ ਦੇਖ ਲਾਂਗੇ ਨੀ ਐਮੋਜੋਨ ਤੇ ਐਮਜੋਨ ਤੇ ਦੇਖ ਲਾਂਗੇ ਹਨਾ ਵੀ ਜੇ ਗਾਊਨ ਮਿਲ ਗਿਆ ਨਹੀਂ ਤਾਂ ਫਿਰ ਸਾੜੀ ਲੈ ਲਾਂਗੇ ਪੀਚ ਕਲਰ ਦੀ ਜਾਂ ਪਿੰਕ ਕਲਰ ਦੀ ਉਹਨਾਂ ਚੋਂ ਜਿਹੜੇ ਵੀ ਪਸੰਦ ਆ ਗਈ ਫਿਰ ਆਰਡਰ ਕਰ ਦਾਂਗੇ